ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਇੱਥੇ ਆਪਣਾ ਜਿਵੇਂ ਕਾਂ ਹੋ ਗਿਆ ਚਿੜੀਆਂ ਹੋ ਗਈਆਂ ਇਹ ਪੰਛੀ ਜ਼ਿਆਦਾਤਰ ਦੇਖੇ ਜਾਂਦੇ ਨੇ ਅਤੇ ਇੱਲ ਹੋ ਗਈ ਬਾਜ਼ ਹੋ ਗਿਆ ਇਹ ਪੰਛੀ ਜ਼ਿਆਦਾਤਰ ਦੇਖੇ ਜਾਂਦੇ ਨੇ ਅਤੇ ਬਾਕੀ ਜਿਹੜੇ ਅਲੱਗ ਕਿਸਮ ਦੇ ਪੰਛੀ ਹੋ ਗਏ ਉਹ ਰੁੱਤਾਂ ਦੇ ਹਿਸਾਬ ਨਾਲ ਆਉਂਦੇ ਨੇ ਅਤੇ ਉਹਨਾਂ ਨੂੰ ਇੱਕ ਥਾਂ 'ਤੇ ਬੈਠਦੇ ਤਾਂ ਉਹ ਘੱਟ ਨੇ ਅਤੇ ਬੈਠੇ ਤਾਂ ਜ਼ਿਆਦਾਤਰ ਦੇਖਣਾ ਸੰਭਵ ਵੀ ਨਹੀਂ ਹੈਗਾ ਅਤੇ ਉਹਨਾਂ ਨੂੰ ਤਾਂ ਉੱਡਦੇ ਹੀ ਦੇਖਿਆ ਜਾਂਦਾ ਅਤੇ ਮੈਂ ਆਪਣੇ ਕਬੂਤਰ ਜ ਮੇਰਾ ਪਸੰਦੀਦਾ ਪੰਛੀ ਹੈ ਜਿਹੜਾ ਮੈਂ ਰੱਖਿਆ ਵੀ ਹੋਇਆ ਅਤੇ ਉਹਨੂੰ ਮੈਂ ਪਾਲਣਾ ਪਸੰਦ ਵੀ ਕਰਦਾ ਅਤੇ ਇਹਨਾਂ ਨੂੰ ਮੈਂ ਰੋਜ਼ ਆਪਣਾ ਚੋਗਾ ਵੀ ਪਾਉਂਦਾ ਅਤੇ ਸਵੇਰੇ ਸ਼ਾਮ ਇਹਨਾਂ ਨੂੰ ਉਡਾਉਂਦੇ ਵੀ ਹਾਂ ਅਸੀਂ